ਮੈਂ ਵੀਡੀਓ ਗੇਮਾਂ ਖੇਡਣ ਦਾ ਬਹੁਤ ਸ਼ੌਕੀਨ ਹਾਂ ਪੁਰਾਣੇ ਸਮੇਂ ਦੇ ਵਿੱਚ ਵੀਡੀਓ ਗੇਮਾਂ ਵੱਲ ਲੋਕਾਂ ਦਾ ਰੁਝਾਅ ਘੱਟ ਹੁੰਦਾ ਸੀ ਅਤੇ ਲੋਕ ਬਾਹਰ ਜਾ ਕੇ ਗੁੱਲੀ ਡੰਡਾ ਅਤੇ ਕ੍ਰਿਕਟ ਆਦਿ ਵਰਗੀਆਂ ਗੇਮਾਂ ਖੇਡਣਾ ਜ਼ਿਆਦਾ ਪਸੰਦ ਕਰਦੇ ਸਨ ਪੁਰਾਣੇ ਸਮੇਂ ਦੇ ਵਿੱਚ ਵੀਡੀਓ ਗੇਮਾਂ ਵੀ ਦੋ ਤਿੰਨ ਕਿਸਮ ਦੀਆਂ ਹੀ ਹੁੰਦੀਆਂ ਸਨ ਪਰ ਜਿਵੇਂ ਜਿਵੇਂ ਤਕਨੀਕ ਦੇ ਵਿੱਚ ਇੰਪਰੂਵਮੈਂਟ ਹੋਈ ਉਸ ਨਾਲ ਕੰਪਿਊਟਰ ਟੈਕਨੋਲੋਜੀ ਦੇ ਵਿੱਚ ਬਹੁਤ ਵਾਧਾ ਹੋਇਆ ਅਤੇ ਇਸਦਾ ਪ੍ਰਭਾਵ ਅਸੀਂ ਗੇਮਾਂ ਦੇ ਵਿੱਚ ਵੀ ਦੇਖ ਸਕਦੇ ਹਾਂ ਅੱਜ ਕੱਲ੍ਹ ਦੀਆਂ ਆਉਣ ਵਾਲੀਆਂ ਨਵੀਆਂ ਨਵੀਆਂ ਗੇਮਾਂ ਬਹੁਤ ਹੀ ਵਧੀਆ ਗ੍ਰਾਫਿਕਸ ਨਾਲ ਹੁੰਦੀਆਂ ਹਨ ਉਹਨਾਂ ਨੂੰ ਖੇਡਦੇ ਹੋਏ ਇੰਝ ਲੱਗਦਾ ਹੈ ਕਿ ਜਿਵੇਂ ਅਸੀਂ ਖੁਦ ਹੀ ਉਸ ਗੇਮ ਨੂੰ ਅਨੁਭਵ ਕਰ ਰਹੀਏ ਹੋਈਏ ਅੱਜ ਕੱਲ੍ਹ ਵੀਅਰ ਗਲਾਸਿਸ ਵਰਗੀ ਨਵੀਂ ਨਵੀਂ ਟੈਕਨੋਲੋਜੀ ਵੀ ਆਉਣ ਲੱਗ ਗਈ ਹੈ ਅੱਜ ਕੱਲ੍ਹ ਗੇਮਾਂ ਔਨਲਾਈਨ ਹੋਣ ਦੇ ਕਾਰਨ ਲੋਕ ਮਲਟੀਪਲੇਅਰ ਗੇਮਾਂ ਆਪਣੇ ਦੋਸਤਾਂ ਦੇ ਨਾਲ ਰਲ ਕੇ ਵੀ ਖੇਡ ਸਕਦੇ ਹਨ ਅਤੇ ਆਪਣਾ ਮਨੋਰੰਜਨ ਕਰ ਸਕਦੇ ਹਨ ਜਿਵੇਂ ਕਿ ਬੀ ਜੀ ਐੱਮ ਆਈ ਕਲੈਸ਼ ਔਫ ਕਲੈਸ਼ ਆਦਿ ਗੇਮਾਂ ਬਹੁਤ ਪ੍ਰਚਲਿਤ ਹਨ ਸਿੰਗਲ ਪਲੇਅਰ ਗੇਮਾਂ ਦੇ ਵਿੱਚ ਗੋਡ ਫੋਰ ਸਪਾਈਡਰਮੈਨ ਵਰਗੀਆਂ ਗੇਮਾਂ ਵੀ ਬਹੁਤ ਪ੍ਰ ਪ੍ਰਚਲਿਤ ਹਨ ਇਹ ਗੇਮਾਂ ਦੇ ਵਿੱਚ ਅਸੀਂ ਇੱਕ ਪਾਤਰ ਦਾ ਕਿਰਦਾਰ ਨਿਭਾਅ ਸਕਦੇ ਹਨ ਅਤੇ ਇਹ ਗੇਮਾਂ ਬਹੁਤ ਮਨੋਰੰਜਕ ਹੁੰਦੀਆਂ ਹਨ